ਪੰਜਾਬ ਹੈ ਜਿਹੜਾ ਇਹ ਆਪਾਂ ਇਹ ਕਹਾਂਗੇ ਵੀ ਇਹ ਗੁਰੂਆਂ ਪੀਰੀਆਂ ਦੀ ਧਰਤੀ ਹੈ ਔਰ ਪੰਜਾਬ ਦੇ ਨਾਮ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਪੰਜ ਆਬ ਪੰਜ ਦਰਿਆਵਾਂ ਦੀ ਧਰਤੀ ਪੰਜ ਦਰਿਆ ਤਾਂ ਚਲੋ ਹੁਣ ਨਹੀਂ ਰਹੇ ਦਰਿਆ ਤਾਂ ਇੱਥੇ ਢਾਈ ਨੇ ਪਰ ਢਾਈਆਂ ਕਰਕੇ ਵੀ ਪੰਜਾਬ ਦੇ ਵਿੱਚ ਪਾਣੀ ਦੀ ਪਰਮਾਤਮਾ ਵੱਲੋਂ ਬੇਅੰਤ ਦਾਤ ਬਖਸ਼ੀ ਹੋਈ ਹੈ ਅਤੇ ਪਾਣੀਆਂ ਕਰਕੇ ਜਿਹੜੀ ਇੱਥੋਂ ਦੀ ਧਰਤੀ ਹੈ ਉਹ ਵੀ ਉਪਜਾਊ ਹੈ ਅਤੇ ਜਿਹੜੇ ਇੱਥੋਂ ਦੇ ਲੋਕ ਨੇ ਉਹ ਵੀ ਵਧੀਆ ਜੁੱਸੇ ਵਾਲੇ ਅਤੇ ਤਕੜੇ ਨੇ ਅਤੇ ਇਸ ਕਰਕੇ ਜਿਹੜਾ ਇਹਨਾਂ ਦਾ ਜੇ ਰਿਹਾਇਸ਼ ਵਧੀਆ ਹੋਵੇਗੀ ਖਾਣਾ ਪੀਣਾ ਵਧੀਆ ਹੋਵੇਗਾ ਤਾਂ ਉਹ ਫ਼ਿਰ ਅਧਿਆਤਮਿਕ ਤੌਰ 'ਤੇ ਵੀ ਸੁਖੀ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਇਹ ਧਰਮ ਵੱਲ ਬਹੁਤ ਨੇ ਔਰ ਬਹੁਤ ਸੁਚੇਤ ਵੀ ਨੇ ਅਤੇ ਇਹਨਾਂ ਦੇ ਜਿਹੜੇ ਮੰਦਰ ਗੁਰਦੁਆਰੇ ਨੇ ਉਹ ਬਹੁਤ ਹੀ ਰੀਝ ਦੇ ਨਾਲ਼ ਇਹਨਾਂ ਨੇ ਬਣਾਏ ਹੋਏ ਨੇ ਔਰ ਬਹੁਤ ਹੀ ਦਿਲ ਦੇ ਨਾਲ਼ ਰੀਝ ਦੇ ਨਾਲ਼ ਇਹ ਉਹਨਾਂ ਸਥਾਨਾਂ 'ਤੇ ਜਾ ਕੇ ਸੇਵਾ ਵੀ ਕਰਦੇ ਨੇ ਅਤੇ ਇਹਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਵਿੱਚ ਇਨਸਾਨੀਅਤ ਦੀ ਭਾਵਨਾ ਮੈਨੂੰ ਇਹ ਲੱਗਦਾ ਵੀ ਭਾਰਤ ਦੀਆਂ ਸਾਰੀਆਂ ਸਟੇਟਾਂ ਦੇ ਨਾਲ਼ੋਂ ਵੱਖਰੀ ਔਰ ਵਧੀਆ ਹੀ ਹੈ ਅਤੇ ਲੋਕ ਬਹੁਤ ਮਿਲਣਸਾਰ ਅਤੇ ਬਹੁਤ ਮਦਦਗਾਰ ਲੋਕ ਨੇ ਮੈਨੂੰ ਇਹ ਲੋਕ ਬਹੁਤ ਪਸੰਦ ਨੇ ਮੈਨੂੰ ਬਹੁਤ ਮਾਣ ਹੈ ਪੰਜਾਬ ਅਤੇ ਪੰਜਾਬੀਅਤ 'ਤੇ ਧੰਨਵਾਦ